ਤੁਸੀਂ ਆਪਣੇ ਮਾਤਾ ਪਿਤਾ ਦੀ ਮੌਤ ਦੇ ਰਿਕਾਰਡ ਵਿੱਚ ਇੱਕ ਗਲਤੀ ਲੱਭੀ ਜਿਵੇਂ ਕਿ ਮੌਤ ਦਾ ਗਲਤ ਕਾਰਨ ਅਤੇ ਤੁਸੀਂ ਇਸ ਨੂੰ ਠੀਕ ਕਰਨਾ ਚਾਹੁੰਦੇ ਹੋ ਕਲਪਨਾ ਕਰੋ ਕਿ ਤੁਸੀਂ ਰਜਿਸਟਰੇਸ਼ਨ ਦਫਤਰ ਨੂੰ ਇੱਕ ਈਮੇਲ ਲਿਖ ਰਹੇ ਹੋ ਆਪਣੇ ਮਾਤਾ ਪਿਤਾ ਦੀ ਮੌਤ ਦੇ ਰਿਕਾਰਡ ਵਿੱਚ ਪਾਈ ਗਈ ਗਲਤੀ ਦਾ ਸਪੱਸ਼ਟ ਤੌਰ 'ਤੇ ਵਰਨਣ ਕਰੋ ਅਤੇ ਜਾਣਕਾਰੀ ਨੂੰ ਅਪਡੇਟ ਕਰਨ ਲਈ ਮਾਰਗਦਰਸ਼ਨ ਦੀ ਬੇਨਤੀ ਕਰੋ ਕੋਈ ਵੀ ਢੁੱਕਵਾਂ ਵੇਰਵਾ ਪ੍ਰਦਾਨ ਕਰੋ ਜਿਵੇਂ ਕਿ ਮੌਤ ਦਾ ਸਹੀ ਕਾਰਨ ਉਹਨਾਂ ਨੂੰ ਸੁਧਾਰ ਦੀ ਪ੍ਰਕਿਰਿਆ ਲਈ ਮੈਂ ਰਜਿਸਟਰੇਸ਼ਨ ਦਫਤਰ ਵਿੱਚ ਇੱਕ ਈਮੇਲ ਪਾਈ ਸੀ ਅਤੇ ਮੈਨੂੰ ਕਾਫੀ ਮਸਟੇਕਸ ਦਾ ਪਤਾ ਲੱਗਿਆ ਮੈਂ ਉਹਨਾਂ ਨੂੰ ਸਧਾਰਨ ਲਈ ਮਤਲਬ ਮੌਤ ਦੇ ਕਾਰਨ ਨੂੰ ਸਹੀ ਕਰਨ ਲਈ ਮੈਂ ਕਿਹੜੇ ਅਧਿਕਾਰੀ ਕੋਲ ਜਾਵਾਂ ਅਤੇ ਮੇਰੀ ਇਹਦੇ ਵਿੱਚ ਥੋੜ੍ਹੀ ਹੈਲਪ ਕੀਤੀ ਜਾਵੇ ਕਿਉਂਕਿ ਮੈਂ ਮਤਲਬ ਇਹਦੇ ਵਿੱਚ ਕਾਫੀ ਮਿਸਟੇਕਸ ਲੱਭੀਆਂ ਅਤੇ ਉਹ ਮੈਨੂੰ ਮਾਰਕ ਕੌਣ ਮਤਲਬ ਮਾਰਗ ਦਰਸ਼ਨ ਕਰ ਸਕਦਾ ਅਤੇ ਮੈਨੂੰ ਪਤਾ ਲੱਗੇ ਇਹਨੂੰ ਸੁਧਾਰ ਕਰਨ ਲਈ ਮਤਲਬ ਮੈਨੂੰ ਅੱਗੇ ਤੋਂ ਥੋੜ੍ਹਾ ਵੀ ਮਤਲਬ ਦੱਸਿਆ ਜਾਵੇ